ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਇਹ ਪੰਜਾਬ ਦੇ ਮੇਲਿਆਂ ਦੀ ਸ਼ਾਨ ਹੈ ਭੰਗੜਾ ਵਿਆਹਾਂ 'ਤੇ ਖੁਸ਼ੀ ਦੇ ਮੌਕੇ 'ਤੇ ਪ੍ਰਗਟਾਇਆ ਜਾਂਦਾ ਹੈ ਭੰਗੜਾ ਤਿਉਹਾਰਾਂ 'ਤੇ ਮੇਲਿਆਂ ਦੀ ਸ਼ਾਨ ਹੈ ਸਕੂਲਾਂ ਕਾਲਜਾਂ ਦੇ ਸਮਾਰੋਹਾਂ ਵਿੱਚ ਭੰਗੜਾ ਮੁੰਡਿਆਂ ਦੀ ਮਨਪਸੰਦੀ ਨਾਚ ਹੈ ਭੰਗੜਾ ਪੰਜਾਬੀਆਂ ਦਾ ਪ੍ਰਸਿੱਧ ਅਤੇ ਮਹੱਤਵਪੂਰਨ ਨਾਚ ਹੈ ਇਸ ਤੋਂ ਇਲਾਵਾ ਵੀ ਪੰਜਾਬੀਆਂ ਦੇ ਬਹੁਤ ਸਾਰੇ ਲੋਕ ਨਾਚ ਹਨ ਪਰ ਭੰਗੜਾ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ ਭੰਗੜਾ ਦੇ ਸਮੇਂ ਜਿਹੜੀ ਪੋਸ਼ਾਕ ਪਾਈ ਜਾਂਦੀ ਹੈ ਉਹ ਗੂੜੇ ਰੰਗ ਦੇ ਕੱਪੜੇ ਹੁੰਦੇ ਹਨ ਕੁੜਤੇ ਚਾਦਰੇ ਹੁੰਦੇ ਹਨ ਲਹਿਰਾਉਂਦੀਆਂ ਤੁਰਲੇ ਵਾਲੀਆਂ ਪੱਗਾਂ ਹੁੰਦੀਆਂ ਹਨ ਹਰ ਕੋਈ ਇਸ ਪਹਿਰਾਵੇ ਨੂੰ ਖਿੱਚਦਾ ਹੈ ਹਰ ਕੋਈ ਇਸ ਪਹਿਰਾਵੇ ਨੂੰ ਪਸੰਦ ਕਰਦਾ ਹੈ ਵਧੀਆ ਜੁੱਤੀਆਂ ਅਤੇ ਖੁੰਡੇ ਸੋਹਣੀਆ ਪੱਗਾਂ ਗਲੇ ਵਿੱਚ ਕੈਂਠੇ ਦੇਖ ਕੇ ਹਰੇਕ ਦਾ ਭੰਗੜਾ ਪਾਉਣ ਨੂੰ ਦਿਲ ਮੱਲੋ ਮੱਲੀ ਕਰਨ ਲੱਗ ਪੈਂਦਾ ਹੈ ਭੰਗੜਾ ਪੰਜਾਬੀਆਂ ਦੀ ਖੁਸ਼ੀ ਪ੍ਰਗਟਾਉਂਦਾ ਹੈ ਭੰਗੜਾ ਲੋਕ ਨਾਚ ਸਾਡਾ ਮੁੱਖ ਲੋਕ ਨਾਚ ਹੈ ਕਿਉਂਕਿ ਪੰਜਾਬੀ ਆਪਣੀ ਖੁਸ਼ੀ ਪ੍ਰਗਟਾਉਣ ਲਈ ਭੰਗੜੇ ਦੀ ਵਰਤੋਂ ਕਰਦੇ ਹਨ ਭੰਗੜਾ ਹਰ ਇੱਕ ਵਰਗ ਦੇ ਮਨੁੱਖ ਪਾਉਂਦੇ ਹਨ ਭਾਵ ਭੰਗੜਾ ਜਵਾਨ ਬਜ਼ੁਰਗ ਸਾਰੇ ਹੀ ਪਾ ਸਕਦੇ ਹਨ ਕਿਉਂਕਿ ਭੰਗੜਾ ਸਾਡਾ ਮੁੱਖ ਲੋਕ ਨਾਚ ਹੈ ਇਹ ਪੰਜਾਬੀਆਂ ਦੀ ਖੁਸ਼ੀ ਪ੍ਰਗਟਾਉਣ ਦਾ ਸਾਧਨ ਹੈ ਇਸ ਵਿੱਚ ਪੰਜਾਬੀ ਤੁਰਲੇ ਵਾਲੀਆਂ ਪੱਗਾਂ ਬੰਨਦੇ ਹਨ ਲੰਮਾ ਕੁੜਤਾ ਪਾਉਂਦੇ ਹਨ ਜਾਕਟਾਂ ਪਾਉਂਦੇ ਹਨ ਖੁੱਲ੍ਹਾ ਚਾਦਰਾ ਪਾਉਂਦੇ ਹਨ ਉਹਨਾਂ ਦੇ ਗਲਾਂ ਵਿੱਚ ਕੈਂਠੇ ਹੁੰਦੇ ਹਨ ਸੁਨਹਿਰੀ ਚਿਮਟਾ ਹੱਥ ਵਿੱਚ ਫੜਦੇ ਹਨ ਖੁੰਡਾ ਅਤੇ ਤਿੱਲੇ ਵਾਲੀ ਜੁੱਤੀ ਪੰਜਾਬੀ ਭੰਗੜੇ ਦੇ ਪਹਿਰਾਵੇ ਵਿੱਚ ਵਰਤਦੇ ਹਨ